ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਰਨਜੀ ਸਿੰਘ ਹੈ ਅਤੇ ਮੈਂ ਤੁਹਾਡੇ ਢਾਬੇ ਤੋਂ ਪਹਿਲਾਂ ਕੁਝ ਚੀਜ਼ਾਂ ਔਡਰ ਕੀਤੀਆਂ ਸੀਗੀਆਂ ਜਿਵੇਂ ਕਿ ਮੈਂ ਪਹਿਲਾਂ ਤੁਹਾਡੇ ਢਾਬੇ ਤੋਂ ਮ ਜੂਸ ਮੱਖਣ ਅਤੇ ਲੱਸੀ ਆਦਿ ਔਡਰ ਕੀਤਾ ਸੀਗਾ ਅਤੇ ਮੈਂ ਇਸ ਵਿੱਚ ਕੁਝ ਹੋਰ ਚੀਜ਼ਾਂ ਐਡ ਕਰਨਾ ਚਾਹੁੰਦਾ ਹਾਂ ਜਿਵੇਂ ਕਿ ਮੈਂ ਚਾਹੁੰਦਾ ਹਾਂ ਕਿ ਇਸ ਵਿੱਚ ਇੱਕ ਹੋਰ ਤਰ੍ਹਾਂ ਦਾ ਅਲੱਗ ਤਰ੍ਹਾਂ ਦਾ ਜੂਸ ਐਡ ਕੀਤਾ ਜਾਵੇ ਅਤੇ ਤਿੰਨ ਕੋਕ ਦੀਆਂ ਬੋਤਲਾਂ ਵੀ ਐਡ ਕੀਤੀਆਂ ਜਾਣ ਅਤੇ ਇਹ ਔਡਰ ਜਲਦੀ ਤੋਂ ਜਲਦੀ ਮੇਰੇ ਘਰ ਪਹੁੰਚਾਇਆ ਜਾਵੇ ਧੰਨਵਾਦ